ਟੈਕਨੋਲਜੀ ਆਉਣ ਨਾਲ਼ ਲੋਕਾਂ ਨੂੰ ਬਹੁਤ ਤਰ੍ਹਾਂ ਦੇ ਫਾਉਦੇ ਹੋਏ ਹਨ ਟੈਕਨੋਲਜੀ ਇੱਕ ਬਹੁਤ ਵਧੀਆ ਚੀਜ਼ ਹੈ ਟੈਕਨੋਲਜੀ ਬਹੁਤ ਚੀਜਾਂ ਵਿੱਚ ਆਈ ਹੈ ਜਿਵੇਂ ਨਵੀਂ ਨਵੀਂਆਂ ਮਸ਼ੀਨਾਂ ਚੱਲੀਆਂ ਹਨ ਟੀ ਵੀ ਚੱਲੇ ਹਨ ਨਵੇਂ ਤਰ੍ਹਾਂ ਦੇ ਪਹਿਲੇ ਜਮਾਨੇ ਵਿੱਚ ਏ ਸੀ ਵੀ ਨਹੀਂ ਹੁੰਦੇ ਸੀ ਹੁਣ ਏ ਸੀ ਵੀ ਆ ਗਏ ਹਾਣ ਅਤੇ ਮੋਬਾਇਲ ਫ਼ੋਨ ਵੀ ਆ ਗਏ ਹਾਂ ਜਿਸ ਦੀ ਮਦਦ ਨਾਲ਼ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋਈਆਂ ਹਨ ਮੋਬਾਇਲ ਫ਼ੋਨ ਨਾਲ਼ ਅਸੀਂ ਹਰ ਇੱਕ ਚੀਜ ਦਾ ਵਧੀਆ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਸਾਨੂੰ ਕਿਸੇ ਕਿਤੇ ਪੈਸਿਆਂ ਦੀ ਲੋੜ ਹੈ ਅਤੇ ਸਾਡੇ ਕੋਲ਼ ਕੈਸ਼ ਨਹੀਂ ਹੈ ਤਾਂ ਅਸੀਂ ਫ਼ੋਨ ਵਿੱਚੋਂ ਹੀ ਉਸ ਦੁਕਾਨਦਾਰ ਜਾਂ ਕਿਸੇ ਹੋਰ ਨੂੰ ਪੈਸੇ ਭੇਜ ਸਕਦੇ ਹਾਂ ਇਸ ਨਾਲ਼ ਸਾਡੀ ਮਦਦ ਹੋਈ ਹੈ ਅਤੇ ਸਾਡੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹਨ ਅਸੀਂ ਘ ਜਿਵੇਂ ਘਰ ਬਦਲਦੇ ਹਨ ਸਾਨੂੰ ਬਹੁਤ ਚੀਜਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣੀ ਪੈਂਦੀ ਹੈ ਜਿਸ ਨਾਲ਼ ਸਾਨੂੰ ਬਹੁਤ ਦਿੱਕਤ ਹੁੰਦੀ ਹੈ ਨਵੀਆਂ ਨਵੀਆਂ ਬਾਈਕਾਂ ਟਰੱਕ ਟਰਾਲੀਆਂ ਨਾਲ਼ ਸਾਡਾ ਕੰਮ ਅਸਾਨ ਹੋ ਗਿਆ ਹੈ ਅਸੀਂ ਬਹੁਤ ਸਾਰੀਆਂ ਚੀਜ਼ਾਂ ਜੋ ਕੁਛ ਵੀ ਲੈ ਕੇ ਜਾਣਾ ਹੈ ਅਸੀਂ ਟਰੱਕ ਜਾਂ ਕਿਸੀ ਚੀਜ਼ ਤੇ ਲੈ ਕੇ ਜਾ ਸਕਦੇ ਹਾਂ